ਮੈਨੂੰ ਖਾਣਾ ਬਣਾਉਣਾ ਬਹੁਤ ਪਸੰਦ ਮੈਂ ਹਰ ਟਾਈਮ ਕੁਛ ਨਾ ਕੁਛ ਰਸੋਈ ਵਿੱਚ ਆਪਣੀ ਕੁਛ ਨਾ ਕੁਛ ਨਵੀਂ ਤੋਂ ਨਵੀਂ ਚੀਜ਼ਾਂ ਟਰਾਈ ਕਰਦਾ ਰਹਿੰਦਾ ਹਨ ਅਤੇ ਮੈਂ ਆਪਣਾ ਕਿ ਰਸੋਈ ਘਰ ਆਪਣੀ ਮਾਤਾ ਜੀ ਨਾਲ ਸਿ ਜ਼ਿਆਦਾ ਸ਼ੇਅਰ ਕਰਨਾ ਪਸੰਦ ਕਰਦਾ ਹਨ ਜਿਸ ਤਰ੍ਹਾਂ ਕਿ ਲਾਇਕ ਕੋਈ ਵੀ ਚੀਜ਼ ਹੋਵੇ ਅਸੀਂ ਇਕੱਠੇ ਬਣਾਉਂਦੇ ਹਾਂ ਇੱਕ ਦੂਜੇ ਦੀ ਹੈਲਪ ਕਰ ਲੈਂਦੇ ਹਾਂ ਜਿੱਦਾਂ ਕਿ ਕਈ ਇੱਦਾਂ ਦੀਆਂ ਚੀਜ਼ਾਂ ਨੇ ਜਿਸ ਵਿੱਚ ਮੈਂ ਅਤੇ ਮੇਰੀ ਮਾਤਾ ਜੀ ਇੱਕ ਦੂਜੇ ਨਾਲ ਕੰਮ ਸ਼ੇਅਰ ਕਰਕੇ ਰਸੋਈ ਦਾ ਗੱਲਾਂ ਵੀ ਕਰ ਕਰ ਲੈਂਦੇ ਹਨ ਜਿਵੇਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਟਾਈਮ ਅਸੀਂ ਇਕੱਠੇ ਨਹੀਂ ਹੁੰਦੇ ਉਸ ਟਾਈਮ ਅਸੀਂ ਇਕੱਠੇ ਹੁੰਦੇ ਹਾਂ ਕੋਈ ਵੀ ਕੋਈ ਜ਼ਰੂਰੀ ਗੱਲ ਅਸੀਂ ਉਸ ਟਾਈਮ ਵੀ ਕਰ ਲੈਂਦੇ ਹਾਂ ਜਿਸ ਤਰ੍ਹਾਂ ਕਿ ਆਪਾਂ ਇਕੱਠੇ ਚੀਜ਼ਾਂ ਬਣਾਉਂਦੇ ਹਾਂ ਜਿੱਦਾਂ ਕਿ ਲਗਾ ਲਓ ਸਾਗ ਹੋ ਗਿਆ ਸਰੋਂ ਦਾ ਉਸ ਤੋਂ ਬਾਅਦ ਜਾਂ ਕੜੀ ਹੋ ਗਈ ਉਸਨੂੰ ਕੱਢਣਾ ਕੱਟਣਾ ਸਾਗ ਨੂੰ ਫਿਰ ਉਸਦੀ ਸੀਟੀਆਂ ਮਰਵਾਉਣੀਆ ਫਿਰ ਉਸ ਤੋਂ ਬਾਅਦ ਉਸ ਨੂੰ ਕੱਟ ਕੇ ਉਹ ਬਣਾਉਣਾ ਆਪਣੇ ਕੂਕਰ 'ਚ ਪਾ ਕੇ ਅਤੇ ਫਿਰ ਉਸ ਨੂੰ ਤੜਕਾ ਲਗਾਉਣਾ ਜਿਵੇਂ ਕਿ ਉਸ ਨੂੰ ਤੁਹਾਨੂੰ ਪਤਾ ਹੋਵੇਗਾ ਕਿ ਜਿਸ ਨੂੰ ਉਸਨੂੰ ਘੋਟ ਘੋਟ ਦੇ ਵੀ ਹੈ ਉਹ ਮੈਂ ਕੰਮ ਮੈਂ ਕਰ ਲੈਂਦਾ ਹਾਂ ਕਿ ਤੜਕਾ ਮਾਤਾ ਜੀ ਲਾ ਲੈਂਦੇ ਹਨ ਅਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਇੱਕ ਡਿਸ਼ ਹੋਰ ਜਿੱਦਾਂ ਕੜੀ ਹੋ ਗਈ ਅਸੀਂ ਉਹ ਇਕੱਠੇ ਬਣਾਉਂਦੇ ਹਾਂ ਜਿਸ ਨੂੰ ਪਹਿਲਾਂ ਕਿ ਬੇਸਣ ਰਿੜ ਰਿੜਕਿਆ ਜਾਂਦਾ ਹੈ ਮੱਖਣ ਨੂੰ ਉਸ ਤੋਂ ਬਾਅਦ ਬੇਸਣ ਦੇ ਪਕੌੜੇ ਕੱਢੇ ਜਾਂਦੇ ਹਨ ਕੁਛ ਟਾਈਮ ਕੱਢਦੇ ਕੱਢਦੇ ਅਸੀਂ ਇੱਕ ਦੂਜੇ ਨੂੰ ਖਵਾ ਵੀ ਦਿੰਦੇ ਹਾਂ ਪਕੌੜੇ ਇਸ ਇਸ ਨਾਲ ਇਸ ਨਾਲ ਇਹ ਕੀ ਹੁੰਦਾ ਹੈ ਕਿ ਇੱਕ ਦੂਜੇ ਨਾਲ ਪਿਆਰ ਵੱਧਦਾ ਹੈ ਅਤੇ ਕੁਛ ਟਾਈਮ ਇੱਕ ਦੂਜੇ ਨੂੰ ਸਮਝਣ ਲਈ ਜੇ ਇੱਕ ਦੂਜੇ ਦੀ ਗੱਲਬਾਤ ਸੁਣਨ ਲਈ ਸਾਨੂੰ ਬਹੁਤ ਸਾਰਾ ਸਮੇਂ ਮਿਲ ਜਾਂਦਾ ਹੈ ਇਸ ਨਾਲ ਇਹ ਹੈ ਕਿ ਕੁਛ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲਦੀਆਂ ਹਨ ਕੁਛ ਮੈਂ ਮਾਤਾ ਜੀ ਨੂੰ ਦੱਸ ਸਕਦਾ ਹੈ ਕਿ ਇਸ ਚੀਜ਼ ਇੱਦਾਂ ਬਣਾਵਾਂਗੇ ਤਾਂ ਕੁਛ ਜ਼ਿਆਦਾ ਸੁਆਦ ਬਣੇਗੀ